ਪਿਛਲੇ ਸਮੇਂ ਦੇ ਵਿੱਚ ਔਰਤਾਂ ਨੂੰ ਬਹੁਤ ਹੀ ਜ਼ਿਆਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਜਦੋਂ ਕਿ ਜੇ ਕੋਈ ਔਰਤ ਅੱਗੇ ਵਧਣਾ ਵੀ ਚਾਹੁੰਦੀ ਸੀ ਤਾਂ ਸਮਾਜ ਉਹਨੂੰ ਅੱਗੇ ਨਹੀਂ ਵਧਣ ਦਿੰਦਾ ਸੀ ਉਹਦੇ 'ਤੇ ਲੱਖ ਲੱਖ ਕਿਸਮ ਦੀਆਂ ਗੰਦੀਆਂ ਬੁਰਾਈਆਂ ਕਰਦਾ ਸੀ ਅਤੇ ਉਹਨੂੰ ਅੱਗੇ ਵਧਣ ਤੋਂ ਰੋਕਦਾ ਸੀ ਜੇ ਉਹਨੂੰ ਮੁਸ਼ਕਲ ਨਾਲ ਕਿਤੇ ਨੌਕਰੀ ਵੀ ਮਿਲ ਜਾਂਦੀ ਸੀ ਤਾਂ ਉੱਥੋਂ ਦੇ ਜਿਹੜੇ ਵੀ ਸਟਾਫ ਮੈਂਬਰ ਹੁੰਦੇ ਸਨ ਉਹ ਉਹਨਾਂ ਨੂੰ ਉਹ ਉਹਨੂੰ ਕੰਮ ਨਹੀਂ ਕਰਨ ਦਿੰਦੇ ਸਨ ਉਹਨੂੰ ਹਮੇਸ਼ਾ ਥੱਲੇ ਖਿੱਚਣ ਦੀ ਕੋਸ਼ਿਸ਼ ਕਰਦੇ ਸਨ ਨਾ ਕਿ ਉਹਨੂੰ ਬਾਕੀਆਂ ਨਾਲੋਂ ਪੇਮੈਂਟ ਵੀ ਘੱਟ ਦਿੱਤੀ ਜਾਂਦੀ ਸੀ ਅਤੇ ਕੋਈ ਛੁੱਟੀ ਵੀ ਨਹੀਂ ਦਿੱਤੀ ਜਾਂਦੀ ਸੀ ਕਈ ਵਾਰ ਤਾਂ ਉਹਨਾਂ 'ਤੇ ਜਬਰਦਸਤੀ ਵੀ ਕਰਦੇ ਸਨ ਜਦੋਂ ਕਿ ਉਹ ਕੰਮ 'ਤੇ ਹੁੰਦੀਆਂ ਸਨ ਜਾਂ ਫਿਰ ਕਈ ਵਾਰ ਜਦੋਂ ਇਕੱਲੀਆਂ ਘਰ ਆਉਂਦੀਆਂ ਸਨ ਉਹਨਾਂ ਨਾਲ ਕਈ ਜਣੇ ਛੇੜਖਾਨੀ ਵੀ ਕਰਦੇ ਸਨ ਪਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬਹੁਤ ਚੀਜ਼ਾਂ ਬਦਲ ਗਈਆਂ ਹਨ ਔਰਤਾਂ ਬਹੁਤ ਕੰਪਨੀਆਂ ਚਲਾਉਂਦੀਆਂ ਬਰਾਬਰੀ ਕਰਦੀਆਂ ਹਨ ਮੁੰਡਿਆਂ ਦੀਆਂ ਅਤੇ ਹੁਣ ਉਹ ਕਿਸੇ ਤੋਂ ਵੀ ਘੱਟ ਨਹੀਂ ਹੈਗੀਆਂ ਉਹ ਹਰ ਕਿਸਮ 'ਚ ਅੱਗੇ ਹੈਗੀਆਂ ਹੁਣ ਅੱਜ ਦਾ ਅੱਜ ਦਾ ਸਮਾਂ ਪਿਛਲੇ ਸਮੇਂ ਨਾਲੋਂ ਬਹੁਤ ਚੰਗਾ ਹੈ ਅੱਜ ਕੱਲ੍ਹ ਔਰਤਾਂ ਆਪ ਬਹੁਤ ਜ਼ਿਆਦਾ ਸੇਫ ਮਹਿਸੂਸ ਕਰਦੇ ਹਨ ਕਿਉਂਕਿ ਪੁਲਿਸ ਵੀ ਅੱਜ ਕੱਲ੍ਹ ਬਹੁਤ ਅਪਡੇਟ ਹੋ ਗਈ ਹੈ ਅਤੇ ਔਰਤਾਂ ਦੀ ਰੱਖਿਆ ਕਰਦੀ ਹੈ ਅਤੇ ਬਹੁਤ ਹੀ ਇਹ ਸਾਰੇ ਲ ਸਰਕਾਰ ਨੇ ਕਾਨੂੰਨ ਬਣਾਏ ਹੈ ਜਿਹਦੇ ਨਾਲ ਔਰਤਾਂ ਸ ਹਮੇਸ਼ਾ ਸੁਰੱਖਿਅਤ ਮਹਿਸੂਸ ਕਰਦੀਆਂ ਹਨ